ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਤੋਂ ਕੂਲਰ ਮੰਗਵਾਇਆ ਸੀ ਜੀ ਆਨਲਾਈਨ ਉਹ ਕੂਲਰ ਦੇ ਵਿੱਚ ਸਾਨੂੰ ਕੰਪਨੀ ਦੁਆਰਾ ਇੱਕ ਸਾਲ ਦੀ ਵਰੰਟੀ ਦਿੱਤੀ ਗਈ ਸੀ ਅਤੇ ਕੂਲਰ ਛਪੰਜਾ ਇੰਚੀ ਮੰਗਵਾਇਆ ਗਿਆ ਸੀਗਾ ਉਹ ਕੂਲਰ ਸਾਨੂੰ ਜੀ ਉਹਦੇ 'ਚ ਵਰੰਟੀ ਕਾਰਡ ਵੀ ਨਹੀਂ ਕਿ ਸਾਨੂੰ ਕੋਈ ਭੇਜਿਆ ਗਿਆ ਅਤੇ ਛੋਟਾ ਕੂਲਰ ਸਾਨੂੰ ਭੇਜ ਦਿੱਤਾ ਗਿਆ ਹੈ ਜਿਹਦਾ ਕਿ ਨਾ ਤਾਂ ਪੰਪ ਚੱਲ ਰਿਹਾ ਜੀ ਅਤੇ ਨਾ ਹੀ ਉਸ ਦੀਆਂ ਕੋਈ ਸਵਿਚ ਕੰਮ ਕਰ ਰਹੀ ਹੈ ਅਗਰ ਸਵਿਚ ਕੰਮ ਕਰਨ ਲੱਗ ਜਾਂਦੀ ਹੈ ਤਾਂ ਉਹਦਾ ਪੰਪ ਖੜ ਜਾਂਦਾ ਜੇ ਪੰਪ ਕੰਮ ਕਰਨ ਲੱਗ ਜਾਂਦਾ ਤਾਂ ਸਵਿੱਚ ਆਫ ਹੋ ਜਾਂਦੀ ਐ ਸਾਡੇ ਕਿਰਪਾ ਕਰਕੇ ਇਸ ਕੂਲਰ ਨੂੰ ਵਾਪਸ ਕੀਤਾ ਜਾਵੇ ਕਿਉਂਕਿ ਇਹ ਕੂਲਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਜੋ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਤੁਹਾਡਾ ਕੂਲਰ ਤੁਹਾਨੂੰ ਛਪੰਜਾ ਇੰਚੀ ਮਿਲੂਗਾ ਜੀ ਇਹ ਠੰਡੀ ਹਵਾ ਵਧੀਆ ਕਰੂ ਪੰਪ ਇਹਦਾ ਸਹੀ ਕੰਮ ਕਰੂਗਾ ਔਰ ਇਹਦੀ ਵਰੰਟੀ ਦੋ ਸਾਲਾਂ ਦੀ ਹੋਊਗੀ ਨਾ ਤਾਂ ਸਾਨੂੰ ਵਰੰਟੀ ਕਾਰਡ ਮਿਲਿਆ ਜੀ ਅਤੇ ਨਾ ਹੀ ਇਹਦੀ ਕੋਈ ਕੰਡੀਸ਼ਨ ਬਹੁਤ ਵਧੀਆ ਜਿਸ ਤਰ੍ਹਾਂ ਕੋਈ ਪੁਰਾਣਾ ਕੂਲਰ ਭੇਜ ਦਿੱਤਾ ਗਿਆ ਹੋਵੇ ਸਾਨੂੰ ਸੋ ਕਿਰਪਾ ਕਰਕੇ ਸਾਡਾ ਇਹ ਪ੍ਰੋਡਕਟ ਵਾਪਸ ਕੀਤਾ ਜਾਵੇ ਤਾਂ ਜੋ ਅਸੀਂ ਆਪਦਾ ਕੋਈ ਹੋਰ ਪ੍ਰੋਡਕਟ ਲੈ ਸਕੀਏ ਧੰਨਵਾਦ ਜੀ